ਟੈਕਨੋਲੋਜੀ ਦੇ ਕਾਰਨ ਮੇਰੇ ਲਈ ਮਨੋਰੰਜਨ ਕਾਫੀ ਤਰੀਕੇ ਨਾਲ ਬਦਲਿਆ ਜਿਵੇਂ ਕਿ ਅੱਜ ਦੇ ਟਾਈਮ 'ਤੇ ਕਾ ਸਮਾਰਟਫੋਨ ਦੇ ਕਾਰਨ ਕਾਫੀ ਸਟਰੀਮਿੰਗ ਪਲੈਟਫੋਰਮ ਆ ਗਏ ਆ ਔਨਲਾਈਨ ਕਾਫੀ ਮੋਬਾਇਲ ਐਪਸ ਆ ਜਿੱਥੇ ਅਸੀਂ ਅੱਡ ਅੱਡ ਤਰ੍ਹਾਂ ਦੀਆਂ ਮੂਵੀ ਸ਼ੋਜ ਵੀਡੀਓਜ ਗਾਣੇ ਸੁਣ ਸਕਦੇ ਹਾਂ ਅੱਡ ਅੱਡ ਲੈਂਗੁਏਜ ਦੇ ਵਿੱਚ ਜਿਵੇਂ ਕਿ ਲੇਟੈਸਟ ਅੱਜ ਕੱਲ੍ਹ ਚੱਲ ਰਿਹਾ ਨੈਟਫਲਿਕਸ ਅਤੇ ਯੂਟੀਊਬ ਅਤੇ ਸਪੋਟੀਫਾਈ ਵਰਗੇ ਐਪਸ ਜਿਹਦੇ ਵਿੱਚ ਅਸੀਂ ਕਾਫੀ ਤਰ੍ਹਾਂ ਦੇ ਮਿਊਜਿਕ ਵੀਡੀਓਜ ਮੂਵੀਜ਼ ਸਾਰਾ ਕੁਝ ਦੇਖ ਸਕਦੇ ਹਾਂ ਪਹਿਲਾਂ ਦੇ ਟਾਈਮ 'ਚ ਇਹ ਚੀਜ਼ਾਂ ਬਹੁਤ ਘੱਟ ਹੁੰਦੀਆਂ ਸੀ ਪਹਿਲਾਂ ਸੀਡੀਜ ਰੇਡੀਓ ਯੂਜ ਕਰਦੇ ਹੁੰਦੇ ਸੀ ਲੋਕ ਪਹਿਲਾਂ ਟੈਕਨੋਲੋਜੀ ਇੰਨੀ ਨਹੀਂ ਸੀ ਅੱਜ ਦੇ ਟਾਈਮ 'ਤੇ ਅਸੀਂ ਵਿਊਅਰਸ ਐਜ਼ ਆ ਲਿਸਨਰਜ਼ ਜ਼ਿਆਦਾ ਕੰਟਰੋਲ ਕਰਦੇ ਹਾਂ ਜ਼ਿਆਦਾ ਕੰਜਊਮ ਕਰਦੇ ਹਾਂ ਚੀਜ਼ਾਂ ਨੂੰ ਅਤੇ ਅਸੀਂ ਪੂਰੇ ਵਲਡ ਲੈਵਲ 'ਤੇ ਹਰ ਇੱਕ ਚੀਜ਼ ਸੁਣ ਸਕਦੇ ਹਾਂ ਦੇਖ ਸਕਦੇ ਹਾਂ ਅਤੇ ਸਮਾਰਟਫੋਨ ਕਰਕੇ ਮੈਂ ਇਜੀਲੀ ਪੇਮੈਂਟ ਕਰ ਸਕਦੀ ਹਾਂ ਕਿਤੇ ਬੈਠੇ ਦੁਨੀਆ ਦੇ ਇੱਕ ਕੋਰਨਰ ਤੋਂ ਬਹਿ ਕੇ ਦੂਜੇ ਕੋਰਨਟ 'ਤੇ ਮੈਂ ਇਜੀਲੀ ਪੇਮੈਂਟ ਕਰ ਸਕਦੀ ਹਾਂ ਗੇਮ ਖੇਡ ਸਕਦੀ ਹਾਂ ਪੋਲਸ ਦੇ ਵਿੱਚ ਹਿੱਸੇ ਲੈ ਸਕਦੀ ਹਾਂ ਮੈਂ ਚੈਟ ਕਰ ਸਕਦੀ ਹਾਂ ਵੀਡੀਓ ਕਾਲ 'ਤੇ ਗੱਲ ਕਰ ਸਕਦੀ ਹਾਂ ਕਾਫੀ ਚੀਜ਼ਾਂ ਕਰ ਸਕਦੀ ਹਾਂ ਅੱਜ ਕੱਲ੍ਹ ਦੇ ਟਾਈਮ 'ਚ ਮੈਂ ਟੈਕਨੋਲੋਜੀ ਦੇ ਰਾਹੀਂ ਮੈਂ ਪਾਰਟੀਜ਼ ਵੀ ਦੇਖ ਸਕਦੀ ਹਾਂ ਪਾਰਟੀਜ ਅਟੈਂਡ ਵੀ ਕਰ ਸਕਦੀ ਹਾਂ ਲਾਈਵ ਪਾਰਟੀ ਅਟੈਂਡ ਕਰ ਸਕਦੀ ਹਾਂ ਗਰੁੱਪ ਕਾਲ ਕਰ ਸਕਦੀ ਹਾਂ ਇੱਕ ਸਾਥ ਮੈਂ ਦਸ ਤੋਂ ਪੰਦਰ੍ਹਾਂ ਜਾਂ ਫਿਰ ਵੀਹ ਪੱਚੀ ਲੋਕਾਂ ਨਾਲ ਗਰੁੱਪ ਕਾਲ ਕਰ ਸਕਦੀ ਹਾਂ ਵੱਧ ਤੋਂ ਵੱਧ ਅਲਸੋ ਮੈਂ ਆਪਦੇ ਥੋਟਸ ਆਪਦੀ ਲਾਈਫ ਕਹਿ ਲਓ ਜਾਂ ਫਿਰ ਆਪਦਾ ਡੇਲੀ ਰੂਟੀਨ ਬਾਕੀ ਲੋਕਾਂ ਨੂੰ ਸ਼ੇਅਰ ਕਰ ਸਕਦੀ ਹਾਂ ਜਿਹਦੇ ਕਰਕੇ ਹੋਰ ਲੋਕ ਮੋਟੀਵੇਟ ਹੋ ਸਕਦੇ ਹਨ ਅਤੇ ਅੱਜ ਕੱਲ੍ਹ ਲੋਕ ਇਹ ਬਹੁਤ ਸੁਣ ਰਹੇ ਹਾਂ ਦੇਖ ਰਹੇ ਹਾਂ ਕਿਉਂਕਿ ਪਹਿਲਾਂ ਇਹ ਸਭ ਨਹੀਂ ਸੀਗਾ ਪਹਿਲਾਂ ਸਿਰਫ ਇੱਕ ਸੀਨਾਮੈਟਿਕ ਹਿਸਟਰੀ ਹੁੰਦੀ ਸੀ ਨੋਰਮਲ ਛੋਟੇ ਕੁਆਲਿਟੀ ਦੇ ਵੀਡੀਓਜ ਹੁੰਦੇ ਸੀਗੇ ਮਿਊਜ਼ਿਕ ਬਹੁਤ ਰੇਡੀਓ 'ਤੇ ਸੁਣਦੇ ਹੁੰਦੇ ਸੀ ਪਹਿਲਾਂ ਪੇਮੈਂਟਸ ਆਨਲਾਈਨ ਨਹੀਂ ਸੀਗੀਆਂ ਤਾਂ ਕਰਕੇ ਅੱਜ ਕੱਲ੍ਹ ਲੋਕ ਜ਼ਿਆਦਾ ਟੈਕਨੋਲੋਜੀ ਯੂਜ ਕਰਦੇ ਆ ਮੇਰੇ ਹਿਸਾਬ ਨਾਲ ਇਹ ਬਹੁਤ ਵਧੀਆ ਅਤੇ ਬਹੁਤ ਬੈਨੀਫਿਟ ਆ ਜਿਹਦੇ ਕਰਕੇ ਸਾਡੀ ਲਾਈਫ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਵੱਧ ਰਹੀ ਆ